ਸਾਡੇ ਖੇਤਰ ਵਿੱਚ ਬਹੁਤ ਚੀਜ਼ਾਂ ਇਤਿਹਾਸਿਕ ਹਨ ਜਿਵੇਂ ਕਿ ਮੋਤੀ ਬਾਗ ਗੁਰਦੁਆਰਾ ਅਤੇ ਸ਼ੀਸ਼ ਮਹਿਲ ਅਤੇ ਕਾਲੀ ਮਾਤਾ ਮੰਦਰ ਇਹ ਵੀ ਬਹੁਤ ਪੁਰਾਣੇ ਹਨ ਅਤੇ ਅਤੇ ਇੱਕ ਸਾਡੇ ਇੱਥੇ ਦੁੱਖ ਨਿਵਾਰਨ ਗੁਰਦੁਆਰਾ ਹੈ ਅਤੇ ਜੋ ਕਿ ਬਹੁਤ ਪੁਰਾਣਾ ਹੈ ਅਤੇ ਬਹੁਤ ਇਤਿਹਾਸਿਕ ਹੈ ਅਤੇ ਇੱਕ ਸਾਡੇ ਇੱਥੇ ਕਿਲ੍ਹਾ ਹੈ ਜੋ ਬਹਾਦਰਗੜ੍ਹ ਵਿਖੇ ਸਥਿਤ ਹੈ ਅਤੇ ਇੱਕ ਉਹਦੇ ਅੰਦਰ ਗੁਰਦੁਆਰਾ ਹੈ ਅਤੇ ਇੱਕ ਬਾਹਰ ਗੁਰਦੁਆਰਾ ਹੈ ਜੋ ਕਿ ਬੜੇ ਇਤਿਹਾਸਿਕ ਹਨ ਅਤੇ ਇਹ ਬਹੁਤ ਪੁਰਾਣੇ ਹਨ ਅਤੇ ਲੋਕ ਇਹਨਾਂ ਨੂੰ ਦੂਰ ਦੂਰ ਤੋਂ ਦੇਖਣ ਆਉਂਦੇ ਹਨ ਅਤੇ ਇਹਨਾਂ ਦੀ ਇੱਥੇ ਬਹੁਤ ਮਹੱਤਤਾ ਹੈ ਅਤੇ ਲੋਕ ਇਹਨਾਂ ਨਾਲ ਪਿਕਚਰ ਵੀ ਕਰਵਾਉਣਾ ਪਸੰਦ ਕਰਦੇ ਹਨ ਕਿਉਂਕਿ ਇਹ ਬਹੁਤ ਵੱਡੇ ਹਨ ਅਤੇ ਬਹੁਤ ਵਿਸ਼ਾਲ ਹਨ ਅਤੇ ਇਹਨਾਂ ਨੂੰ ਲੋਕ ਬਹੁਤ ਦੇਖ ਕੇ ਇਹਨਾਂ ਨੂੰ ਹੈਰਾਨ ਹੁੰਦੇ ਹਨ ਅਤੇ ਜਿਸ ਕਰਕੇ ਹੀ ਸਾਡੇ ਇਹ ਖੇਤਰ ਦਾ ਨਾਮ ਵੀ ਉੱਚਾ ਹੁੰਦਾ ਹੈ ਅਤੇ ਸਾਡੇ ਖੇਤਰ ਵਿੱਚ ਇਹ ਸਥਿਤ ਹਨ ਅਤੇ ਸਾਡੇ ਇਹ ਬਹੁਤ ਨੇੜੇ ਹਨ ਜਿਸ ਕਰਕੇ ਅਸੀਂ ਇਹਨਾਂ ਨੂੰ ਆਉਂਦੇ ਜਾਂਦੇ ਵੀ ਦੇਖ ਸਕਦੇ ਹਾਂ ਅਤੇ ਸਾਡੇ ਲਈ ਬਹੁਤ ਮਹੱਤਤਾ ਰੱਖਦੇ ਹਨ